ਮੇਰੇ ਅਨੁਸਾਰ ਕਿਸੇ ਵੀ ਕਾਰੋਬਾਰੀ ਨੂੰ ਔਨਲਾਈਨ ਪੇਮੈਂਟ ਕਰਵਾਉਣੀ ਚਾਹੀਦੀ ਹੈ ਪਰ ਸਾਵਧਾਨੀ ਨਾਲ ਆਨਲਾਈਨ ਪੇਮੈਂਟ ਕਰਨ ਦੇ ਫ਼ਾਇਦੇ ਪੈਸੇ ਤਰੰਤ ਖਾਤੇ ਵਿੱਚ ਆ ਜਾਂਦੇ ਹਨ ਅਤੇ ਨਿਤ ਸੰਭਾਲਣ ਦੀ ਲੋੜ ਨਹੀਂ ਰਹਿੰਦੀ ਹਰ ਲੈਣ ਦੇਣ ਦਾ ਰਿਕਾਰਡ ਹੋਣ ਕਰਕੇ ਅੱਗੇ ਹਿਸਾਬ ਕਿਤਾਬ ਰੱਖਣ ਵਿੱਚ ਆਸਾਨੀ ਰਹਿੰਦੀ ਹੈ ਆਨਲਾਈਨ ਪੇਮੈਂਟ ਦੇ ਕਾਰਨ ਗਾਹਕ ਹੋਰ ਸ਼ਹਿਰਾਂ ਜਾਂ ਦੇਸ਼ਾ ਤੋਂ ਵੀ ਖਰੀਦ ਸਕਦੇ ਹਨ ਇਸ ਦੇ ਕਈ ਨੁਕਸਾਨ ਵੀ ਹਨ ਜਿਵੇਂ ਕਿ ਕਈ ਵਾਰ ਫੇਕ ਆਈ ਡੀ ਯੂ ਪੀ ਆਈ ਕਲੋਨ ਕੀਤੇ ਹੋਏ ਕਿਊ ਆਰ ਕੋਡ ਜਾਂ ਫਿਸ਼ਿੰਗ ਲਿੰਕ ਰਾਹੀਂ ਪੈਸੇ ਚੁੱਕ ਲਏ ਜਾਂਦੇ ਹਨ ਜੇਕਰ ਇੰਟਰਨੈਟ ਦੀ ਸਮੱਸਿਆ ਹੋਵੇ ਜਾਂ ਕੋਈ ਤਕਨੀਕੀ ਗਲਤੀ ਆ ਜਾਵੇ ਤਾਂ ਪੈਸੇ ਫਸ ਸਕਦੇ ਹਨ ਇਸ ਨਾਲ ਹੈਕਿੰਗ ਦਾ ਖ਼ਤਰਾ ਵੀ ਰਹਿੰਦਾ ਹੈ ਇਸ ਤੋਂ ਇਲਾਵਾ ਸਾਡੇ ਪਿੰਡ ਵਿੱਚ ਇੱਕ ਅਜਿਹਾ ਕੇਸ ਹੈ ਜਿਸ ਜਿਸ ਦੇ ਕਾਰਨ ਠੱਗੀ ਹੋਈ ਹੈ ਮੇਰੇ ਪਿੰਡ ਵਿੱਚ ਹੀ ਇੱਕ ਕੰਮ ਕਰਨ ਵਾਲੇ ਕਲਾਕਾਰ ਨਾਲ ਠੱਗੀ ਹੋਈ ਸੀ ਉਸਨੇ ਇੱਕ ਗਾਹਕ ਨੂੰ ਪੰਜਾਬੀ ਫੁਲਕਾਰੀ ਦੁਪੱਟਾ ਆਨਲਾਈਨ ਵੇਚਿਆ ਪਰ ਗਾਹਕ ਨੇ ਫੇਕ ਯੂ ਪੀ ਆਈ ਸਕਰੀਨਸ਼ੋਟ ਭੇਜ ਦਿੱਤਾ ਉਹਨਾਂ ਨੇ ਸੋਚਿਆ ਕਿ ਪੈਸੇ ਆ ਗਏ ਹਨ ਪਰ ਹਕੀਕਤ ਵਿੱਚ ਕੋਈ ਪੇਮੈਂਟ ਨਹੀਂ ਹੋਈ ਬਾਅਦ ਵਿੱਚ ਗਾਹਕ ਦੀ ਕੋਈ ਟਰੈਕਿੰਗ ਨਹੀਂ ਹੋਈ ਅਤੇ ਪੈਸੇ ਨਹੀਂ ਮਿਲੇ ਧੰਨਵਾਦ